ਜ਼ਿੰਦਗੀ ਵਿੱਚ ਕਲਾ ਸਾਡੇ ਬਹੁਤ ਅਹਿਮੀਅਤ ਰੱਖਦੀ ਹੈ ਇਹ ਕਲਾ ਇੱਕ ਰੁਜ਼ਗਾਰ ਦਾ ਕੰਮ ਕਰਦੀ ਹੈ ਕਲਾ ਇੰਨੀ ਕੁ ਹੀ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਕਿ ਕੋਈ ਵੀ ਵਿਅਕਤੀ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਕਲਾ ਹੁੰਦੀ ਹੈ ਜਿਵੇਂ ਕਿ ਗਾਇਕੀ ਡਾਂਸਿੰਗ ਪੇਂਟਿੰਗ ਆਦਿ ਕਲਾ ਸਾਡੇ ਲਈ ਪੂਜਾ ਅਤੇ ਰੁਜ਼ਗਾਰ ਵੀ ਦਿੰਦੀ ਹੈ ਅਤੇ ਇਸ ਨਾਲ ਅਸੀਂ ਆਪਣੀ ਕਲਾ ਨੂੰ ਦੂਸਰੇ ਅੱਗੇ ਪ੍ਰਗਟ ਕਰ ਸਕਦੇ ਹਾਂ ਮੇਰੇ ਅੰਦਰ ਤਾਂ ਪੇਂਟਿੰਗ ਦੀ ਕਲਾ ਹੈ ਜੋ ਕਿ ਮੈਂ ਤੁਹਾਨੂੰ ਦੱਸ ਰਹੀ ਹਾਂ ਪੇਂਟਿੰਗ ਦੀ ਸ਼ੁਰੂਆਤ ਕਰਨ ਵਾਲੇ ਵਿਅਕਤੀ ਦੀ ਪਰਖ ਉਸਦੇ ਹੱਥਾਂ ਦੀ ਕਲਾ ਅਤੇ ਉਸਦੀ ਬਣਾਈ ਪੇਂਟਿੰਗ ਤੋਂ ਹੁੰਦੀ ਹੈ ਸਭ ਤੋਂ ਪਹਿਲਾਂ ਉਸ ਨੂੰ ਸ਼ੇਡਿੰਗ ਅਤੇ ਕਲਰਸ ਬਾਰੇ ਦੱਸਿਆ ਜਾਂਦਾ ਹੈ ਅਤੇ ਫਿਰ ਸਭ ਨੂੰ ਇਹ ਹੁੰਦਾ ਹੈ ਕਿ ਜੋ ਪੇਂਟਿੰਗ ਅਸੀਂ ਕਿਸੇ ਕਾਰੀਗਰ ਜਾਂ ਪੇਂਟਰ ਤੋਂ